ਜਦੋਂ ਵੀ ਮੈਂ ਕੋਈ ਨਵੀਂ ਪੇਂਟਿੰਗ ਬਣਾਉਣ ਦੀ ਕੋਸ਼ਿਸ਼ ਕਰਦੀ ਹਾਂ ਤਾਂ ਮੈਂ ਆਪਣੇ ਆਲੇ ਦੁਆਲੇ ਦਾ ਮਾਹੌਲ ਵੇਖਦੀ ਹਾਂ ਕਿ ਮੈਂ ਮਾਹੌਲ ਸ਼ਾਂਤ ਹੈ ਅਤੇ ਕਈ ਪੇਂਟਿੰਗਸ ਦਾ ਮੈਂ ਆਪਣੇ ਮੂੜ ਦੇ ਹਿਸਾਬ ਨਾਲ ਬਣਾਉਂਦੀ ਹਾਂ ਮੈਨੂੰ ਪੋਂ ਪੇਂਟਿੰਗਸ ਕਰਨੀਆਂ ਬਹੁਤ ਹੀ ਵਧੀਆ ਲੱਗਦੀਆਂ ਹਨ ਮੈਂ ਵੇਖਦੀ ਹਾਂ ਕਿ ਮੇਰਾ ਮੂਡ ਜਿਸ ਹਿਸਾਬ ਨਾਲ ਹੁੰਦਾ ਹੈ ਉਸ ਹਿਸਾਬ ਨਾਲ ਹੀ ਮੈਂ ਪੇਂਟਿੰਗ ਵੇਖਦੀ ਹਾਂ ਅਤੇ ਆਪਣੇ ਆਲੇ ਦੁਆਲੇ ਦੀਆਂ ਚੀਜ਼ਾਂ ਦੇ ਵੱਲ ਵੇਖਦੀ ਹਾਂ ਜਿਹੜੀ ਵੀ ਚੀਜ਼ ਦੇ ਵਿੱਚ ਮੈਨੂੰ ਕੋਈ ਫੀਲਿੰਗਸ ਵਗੈਰਾ ਲੱਗਦੀਆਂ ਹਨ ਉਹ ਹੀ ਚੀਜ਼ ਮੈਂ ਪੇਂਟ ਕਰਦੀ ਹੈਗੀ ਜਿਹਦੇ ਤੋਂ ਜਿਸ ਦਾ ਕੋਈ ਮਕਸਦ ਹੋਵੇ ਮੇਰੀ ਲਾਈਫ ਦੇ ਨਾਲ ਜਾਂ ਫਿਰ ਦੂਜਿਆਂ ਦੀ ਜ਼ਿੰਦਗੀ ਦੇ ਨਾਲ ਅਤੇ ਉਹ ਹੀ ਪੇਂਟਿੰਗਸ ਬਣਾਉਂਦੀ ਹਾਂ ਮੈਂ ਆਪਣੀ ਲਾਈਫ ਵਿੱਚ ਬਹੁਤ ਸਾਰੀਆਂ ਪੇਂਟਿੰਗਸ ਬਣਾਈਆਂ ਗਈਆਂ ਅਕਸਰ ਹੀ ਮੈਂ ਇਕ ਸ਼ਾਂਤ ਮਨ ਦੇ ਨਾਲ ਪੇਂਟਿੰਗ ਬਣਾਉਂਦੀ ਹੈਗੀ ਉਸ ਪੇਂਟਿੰਗ ਦੇ ਵਿੱਚ ਮੈਂ ਆਪਣੀਆਂ ਫੀਲਿੰਗਸ ਅਤੇ ਅਦਰ ਪਰਸਨ ਦੀਆਂ ਫੀਲਿੰਗਸ ਨੂੰ ਫੀਲ ਕਰਕੇ ਹੀ ਕੋਈ ਇੱਕ ਪੇਂਟਿੰਗ ਬਣਾਉਂਦੀ ਹੈਗੀ ਕਿਉਂਕਿ ਮੈਂ ਇਹ ਮਹਿਸੂਸ ਕਰਦੀ ਹਾਂ ਕਿ ਫੀਲਿੰਗਸ ਨੂੰ ਹੀ ਪੇਟਿੰਗ ਕਹਿੰਦੇ ਹੈਗੇ ਅਤੇ ਪੇਂਟਿੰਗ ਦੇ ਵਿੱਚ ਕੋਈ ਸਾਰੀਆਂ ਫੀਲਿੰਗਸ ਹੋਣੀਆਂ ਚਾਹੀਦੀਆਂ ਹੈਗੀਆਂ ਜੋ ਕਿ ਅਦਰ ਪਰਸਨ ਫੀਲ ਕਰ ਰਿਹਾ ਹੈ ਕੋਈ ਦੂਜਾ ਬੰਦਾ ਜੋ ਵੀ ਫੀਲਿੰਗਜ਼ ਨੂੰ ਫੀਲ ਕਰਦਾ ਹੈ ਮੈਂ ਆਪਣੀ ਪੇਂਟਿੰਗ ਦੇ ਵਿੱਚ ਬਿਲਕੁਲ ਉਹ ਹੀ ਫੀਲਿੰਗਸ ਨੂੰ ਦੇਖਣਾ ਪਸੰਦ ਕਰਦੀ ਹਾਂ ਅਤੇ ਮੈਂ ਆਪਣੀ ਪੇਂਟਿੰਗ ਦੇ ਵਿੱਚ ਜ਼ਿਆਦਾਤਰ ਕਲਰਸ ਬਹੁਤ ਘੱਟ ਹੀ ਯੂਜ ਕਰਦੀ ਹਾਂ ਜ਼ਿਆਦਾਤਰ ਤਾਂ ਮੈਂ ਸਕੈਚ ਸਕੈੱਚ ਹੀ ਬਣਾਉਣੇ ਲਾਈਕ ਕਰਦੀ ਹਾਂ ਕਿਉਂਕਿ ਮੈਂ ਹੁਣ ਫੇਸ ਪੇਂਟਿੰਗ ਦੀ ਪ੍ਰੈਕਟਿਸ ਕਰ ਰਹੀ ਹਾਂ ਅਤੇ ਮੈਂ ਅਕਸਰ ਹੀ ਪੇਂਟਿੰਗਸ ਆਪਣੇ ਦਿਲ ਨਾਲ ਕਰਦੀ ਹਾਂ ਜਿਸ ਟਾਈਮ ਮੇਰਾ ਦਿਲ ਕਰਦਾ ਹੈ ਮੈਂ ਉਹ ਹੀ ਟਾਈਮ ਪੇਂਟਿੰਗ ਕਰਦੀ ਹਾਂ ਮੈਨੂੰ ਪੇਂਟਿੰਗਸ ਕਰਨਾ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਪੇਂਟਿੰਗਸ ਦੇ ਨਾਲ ਮੇਰੀ ਇੱਕ ਪਰਸਨਲ ਅਟੈਚਮੈਂਟ ਹੋਈ ਵੀ ਹੈ ਮੈਂ ਆਪਣੇ ਦੁੱਖ ਜਾਂ ਸੁੱਖ ਦੇ ਵਿੱਚ ਪੇਂਟਿੰਗ ਕਰਨੀ ਪਸੰਦ ਕਰਦੀ ਹਾਂ